ਹੈਲੋ ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਕਾਰ ਡੀਲਿੰਗ ਪੁਆਇੰਟ ਤੋਂ ਬੋਲਦੇ ਹੋ ਜੀ ਅਸੀਂ ਠੀਕ ਹੈ ਭਾਅ ਜੀ ਅਸੀਂ ਨਾ ਦਿੱਲੀ ਨੰਬਰ ਗੱਡੀ ਲੈਣੀ ਤੀ ਕਿਹੜੀ ਤੁਹਾਡੇ ਕੋਲ ਕਿਹੜੀ ਕਿਹੜੀ ਅਵੇਲੇਬਲ ਹੈ ਹਾਂ ਠੀਕ ਹੈ ਠੀਕ ਹੈ ਠੀਕ ਠੀਕ ਸਕੌਰਪਿਊ ਦਾ ਕੀ ਪਰਾਇਜ਼ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਠੀਕ ਉਹ ਉਹ ਲਾਈਟਾਂ ਲੂਟਾਂ ਸਭ ਸਹੀ ਹੈ ਨੇ ਬੈਕ ਲਾਇਟਾਂ ਫਰੰਟ ਫਰੰਟ ਲਾਇਟਾਂ ਇੰਨਟੀਰੀਅਰ ਠੀਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਅਤੇ ਜਿਹੜੀ ਆਪਣੇ ਸਕੌਡਾ ਹੈ ਉਹਦਾ ਪਰਾਇਜ਼ ਕੀ ਹੈ ਜੀ ਠੀਕ ਹੈ ਜੀ ਅੱਛਾ ਉਹਦੀ ਕੰਨਡੀਸ਼ਨ ਸਹੀ ਹੈ ਜੀ ਪੇਪਰ ਵਰਕ ਓਕੇ ਹੈ ਰਿਪੋਰਟ ਠੀਕ ਹੈ ਫੁੱਲ ਹੈ ਕਿ ਅੱਛਾ ਅੱਛਾ ਅਤੇ ਕੈਸ਼ ਆਪਣਾ ਫੁੱਲ ਹੈ ਜੀ ਕਿ ਹਾਫ਼ ਹਾਫ਼ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਅਤੇ ਕਿਹੜੇ ਹਾਂਜੀ ਹਾਂਜੀ ਹਾਂਜੀ ਠੀਕ ਹੈ ਆਪਣੀ ਲੋਕੇਸ਼ਨ ਤੁਸੀਂ ਲੋਕੇਸ਼ਨ ਸੈਂਡ ਕਰ ਦਿਓ ਆਪਣੀ ਵੱਟਸਐੱਪ 'ਤੇ ਹਾਂ ਹਾਂ ਇਸ ਹੀ ਉਹ ਨੰਬਰ 'ਤੇ ਕਰ ਦਿਓ ਸੈਂਡ ਲੋਕੇਸ਼ਨ ਮੈਂ ਮੈਂ ਜ਼ਰੂਰ ਆਵਾਂਗਾ ਆਪਣੇ ਪਾਪਾ ਨਾਲ਼ ਦੇਖ ਕੇ ਜਾਵਾਂਗਾ ਗੱਡੀ ਦਿੱਲੀ ਨੰਬਰ ਹੀ ਚਾਹੀਦੀ ਹੈ ਆਪਾਂ ਨੂੰ ਜਾਂ ਸਕੌਰਪਿਊ ਜਾਂ ਸਕੋਡਾ ਕੋਈ ਵੀ ਠੀਕ ਠੀਕ ਹੈ ਜੀ ਠੀਕ ਹੈ ਠੀਕ ਹੈ ਤੁਸੀਂ ਸੈਂਡ ਕਰ ਦਿਉ ਲੋਕੇਸ਼ਨ ਹਾਂ ਹਾਂਜੀ ਓਕੇ ਜੀ ਠੀਕ ਓਕੇ ਓਕੇ ਠੀਕ ਹੈ ਜੀ